ਹਾਂ ਮੈਂ ਸਿੱਧੀ ਅੱਗ 'ਤੇ ਵੀ ਖਾਣਾ ਤਿਆਰ ਕਰਦੀ ਹਾਂ ਇਹਦੇ ਵਿੱਚ ਕੀ ਆ ਆਪਾਂ ਆਪਣੇ ਸਮਰੱਥਾ ਦੇ ਅਨੁਸਾਰ ਜਿਹੜੀ ਆ ਅੱਗ ਬਾਲ਼ ਸਕਦੇ ਹਾਂ ਪਰ ਇਹ ਆ ਵੀ ਸਾਨੂੰ ਇਹਦਾ ਤਾਪਮਾਨ ਨਹੀਂ ਪਤਾ ਲੱਗਦਾ ਜਿਵੇਂ ਕਿ ਸਾਨੂੰ ਗੈਸ ਦਾ ਜੀ ਇਨਡੈਕਸ਼ਨ ਦਾ ਪਤਾ ਚੱਲ ਜਾਂਦਾ ਵਾ ਜਦੋਂ ਜ਼ਿਆਦਾ ਤੇਜ਼ ਅੱਗ ਹੋ ਜਾਂਦੀ ਥੱਲੇ ਆਪਣਾ ਜਿੱਦਾਂ ਆਪਾਂ ਕਿ ਸਬਜ਼ੀ ਨੂੰ ਤਿਆਰ ਕਰਨ ਦੇ ਲਈ ਮਸਾਲਾ ਭੁੰਨਦੇ ਹਾਂ ਅਤੇ ਫਿਰ ਆਪਾਂ ਆਪਣੇ ਹੀ ਅੰਦਾਜ਼ੇ ਜੇ ਦੇ ਨਾਲ ਲੱਕੜਾਂ ਪਿਛਾਂਹ ਕਰ ਦਿੰਦੇ ਹਾਂ ਅਤੇ ਗੈਸ ਦੇ ਅਤੇ ਇੰਡਕਸ਼ਨ 'ਤੇ ਇਹ ਹੁੰਦਾ ਵਾ ਕਿ ਆਪਾਂ ਆਪਣੇ ਪੂਰਾ ਟਾਈਮ ਉਹਦੇ ਆਪਾਂ ਨੂੰ ਦੱਸਿਆ ਹੁੰਦਾ ਵਾ ਆਪਾਂ ਉਸ ਹਿਸਾਬ ਨਾਲ ਉਹ 'ਤੇ ਸਬਜ਼ੀ ਇੰਡੈਕਸ਼ਨ 'ਤੇ ਧਰ ਕੇ ਅਤੇ ਤਾਪਮਾਨ ਦਾ ਆਪਾਂ ਨੂੰ ਪਤਾ ਹੁੰਦਾ ਵਾ ਆਪਾਂ ਬਾਹਰ ਵੀ ਫਿਰਦੇ ਹਾਂ ਫੋਨ 'ਤੇ ਵੀ ਗੱਲ ਕਰ ਲੈਂਦੇ ਹਾਂ ਅਤੇ ਫੇਰ ਘੜੀ ਵੇਖ ਕੇ ਆਪਾਂ ਪੰਦਰਾਂ ਵੀਹ ਮਿੰਟ ਦਾ ਸਮਾਂ ਲਾ ਕੇ ਅੰਦਰ ਚੱਲ ਜਾਂਦੇ ਹਾਂ ਪਰ ਸਿੱਧੀ ਅੱਗ 'ਤੇ ਕੀ ਆ ਜੇ ਆਪਾਂ ਕੋਈ ਚੀਜ਼ ਬਣਾਉਣੀ ਤਾਂ ਆਪਾਂ ਨੂੰ ਉਹਦੇ ਲਾਗੇ ਬਹਿਣਾ ਪੈਂਦਾ ਕਿਉਂਕਿ ਆਪਾਂ ਨੂੰ ਫਿਰ ਤਾਪਮਾਨ ਦਾ ਨਹੀਂ ਨਾ ਪਤਾ ਚੱਲਦਾ ਅਤੇ ਇਹ ਇਹਦੇ ਨਾਲ ਇਹ ਕੀ ਹੁੰਦਾ ਵਾ ਕਿ ਚੀਜ਼ਾਂ ਦੋਵੇਂ ਫ਼ਾਇਦੇਮੰਦ ਆ ਪਰ ਇਹ ਆ ਕਿ ਆਪਣੇ ਹਿਸਾਬ ਦੇ ਨਾਲ ਹੀ ਆਪਾਂ ਨੂੰ ਇਹਦੇ ਨਾਲ ਚੱਲਣਾ ਪੈਂਦਾ ਵਾ ਚੁੱਲ੍ਹੇ ਦੀ ਸਬਜ਼ੀ ਜਿਹੜੀ ਆ ਉਹ ਜ਼ਿਆਦੀ ਸਵਾਦ ਬਣਦੀ ਆ ਰੋਟੀਆਂ ਵੀ ਇਹਦੀਆਂ ਜ਼ਿਆਦੀਆਂ ਸਵਾਦ ਲੱਗਦੀਆਂ ਕਿਉਂਕਿ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਉਹ ਕਹਿੰਦੇ ਕਿ ਜਿਹੜੀ ਗੈਸ ਦੇ ਨਾਲੋਂ ਵਾ ਰੋਟੀ ਜ਼ਿਆਦੀ ਤਿਆਰ ਆਪਾਂ ਨੂੰ ਚੁੱਲ੍ਹੇ ਦੀ ਹੀ ਕਰਕੇ ਖਾਣੀ ਚਾਹੀਦੀ ਆ ਅਤੇ ਅੱਗ ਜਿਹੜੀ ਆ ਗਾ ਸਿਆ ਸਿਆਲ ਦੇ ਵਿੱਚ ਆਪਾਂ ਨੂੰ ਇਹ ਸੇਕਣ ਦਾ ਵੀ ਮਜ਼ਾ ਆਉਂਦਾ ਵਾ ਅਤੇ ਇੰਡੈਕਸ਼ਨ ਦਾ ਇਹ ਆ ਕਿ ਬਿਜਲੀ ਨਾ ਆਵੇ ਅਤੇ ਆਪਾਂ ਫਿਰ ਜੇ ਆਪਣੇ ਘਰ ਚੁੱਲ੍ਹਾ ਵਾ ਨਾ ਨਾ ਹੋਵੇਗਾ ਤਾਂ ਫਿਰ ਆਪਾਂ ਨੂੰ ਰੋਟੀ ਪਾਣੀ ਬਣਾਉਣ 'ਚ ਵੀ ਪ੍ਰੋਬਲਮ ਆਵੇਗੀ ਸੋ ਜ਼ਿਆਦਾ ਫ਼ਾਇਦੇਮੰਦ ਜਿਹੜਾ ਮੈਨੂੰ ਚੁੱਲ੍ਹਾ ਹੀ ਲੱਗਦਾ